ਹਾਂਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਮੈਂ ਤੁਹਾਨੂੰ ਹੁਣੇ ਔਡਰ ਕੀਤਾ ਹੈਗਾ ਹੈ ਉਹਦੇ ਵਿੱਚ ਪੰਜ ਡੱਬੇ ਟੋਟਲ ਹਨ ਜਿਹਦੇ ਵਿੱਚ ਤਿੰਨ ਡੱਬੇ ਬਰਫ਼ੀ ਦੇ ਹਨ ਅਤੇ ਦੋ ਡੱਬੇ ਲੱਡੂਆਂ ਦੇ ਹਨ ਉਹਨਾਂ ਡੱਬਿਆਂ ਦੇ ਵਿੱਚ ਜਿਹੜੇ ਤਿੰਨ ਡੱਬੇ ਹਨ ਉਹ ਹੈ ਬਰਫ਼ੀ ਵਿੱਚ ਮਿੱਠਾ ਘੱਟ ਰੱਖਿਆ ਜਾਵੇ ਅਤੇ ਇੱਕ ਜਿਹੜੀ ਬਰਫ਼ੀ ਹੈ ਡੱਬਾ ਉਹਦੇ ਵਿੱਚ ਮਿੱਠਾ ਤੁਸੀਂ ਪੂਰਾ ਵੀ ਪਾ ਸਕਦੇ ਹਨ ਅਤੇ ਦੋ ਡੱਬਿਆਂ 'ਚ ਮਿੱਠਾ ਘੱਟ ਅਤੇ ਇੱਕ 'ਚ ਵੱਧ ਰੱਖਿਆ ਜਾਵੇ ਅਤੇ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਮਿਠਾਈ ਵਾਲੇ ਡੱਬਿਆਂ ਉੱਤੇ ਇੱਕ ਸਲਿੱਪ ਲਗਾ ਦਿਓ ਜਿਸ ਨਾਲ਼ ਮੈਨੂੰ ਪਤਾ ਲੱਗ ਜੇ ਕਿ ਕਿਹੜੀ ਬਰਫ਼ੀ ਦੇ ਵਿੱਚ ਮਿੱਠਾ ਜ਼ਿਆਦਾ ਹੈ ਅਤੇ ਕਿਹੜੀ ਦੇ ਉੱਤੇ ਮਿੱਠਾ ਘੱਟ ਹੈ ਅਤੇ ਇੱਕ ਮੈਨੂੰ ਕੇਸਰ ਲੱਡੂ ਦਾ ਡੱਬਾ ਕਰਨਾ ਹੈ ਅਤੇ ਦੂਜਾ ਬੂੰਦੀ ਵਾਲੇ ਲੱਡੂ ਦਾ ਡੱਬਾ ਅਤੇ ਬੂੰਦੀ ਵਾਲੇ ਲੱਡੂ ਦੇ ਵਿੱਚ ਤੁਸੀਂ ਉੱਪਰ ਚਾਂਦੀ ਦਾ ਵਰਕ ਜ਼ਰੂਰ ਪਵਾ ਦਿਓ ਤਾਂ ਕਿ ਮੇਰੇ ਬੱਚੇ ਖੁਸ਼ ਹੋ ਕੇ ਖਾ ਲੈਣ ਅਤੇ ਇਸ ਤੋਂ ਇਲਾਵਾ ਤੁਸੀਂ ਮੇਰਾ ਜਿਹੜਾ ਇਹ ਔਡਰ ਹੈ ਦੋ ਵਜੇ ਤੋਂ ਪਹਿਲਾਂ ਮੇਰੇ ਘਰ ਪਹੁੰਚਾ ਦਿਓ ਤਾਂ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ